ਮੇਰਾ ਪੰਜਾਬੀ ਦਾ ਪਸੰਦੀਦਾ ਸਿੰਗਰ ਸਤਿੰਦਰ ਸਰਤਾਜ ਹੈ ਸਤਿੰਦਰ ਸਰਤਾਜ ਪੰਜਾਬ ਦਾ ਬਹੁਤ ਹੀ ਵਧੀਆ ਸਿੰਗਰ ਹੈ ਉਹਨੂੰ ਪਸੰਦ ਕਰਨ ਦੇ ਮੇਰੇ ਚਾਰ ਪੰਜ ਕਾਰਨ ਨੇ ਸਭ ਤੋਂ ਵਧੀਆ ਔਰ ਸਭ ਤੋਂ ਪਹਿਲਾ ਕਾਰਨ ਮੇਰਾ ਤਾਂ ਇਹ ਹੈ ਕਿ ਉਹਨਾਂ ਨੇ ਸੰਗੀਤ ਲਾਈਨ ਵਿੱਚ ਪੀ ਐਚ ਡੀ ਕੀਤੀ ਹੋਈ ਹੈ ਔਰ ਫਾਰਸੀ ਉਰਦੂ ਪੰਜਾਬੀ ਕਈ ਸਾ ਤਰ੍ਹਾਂ ਦੀਆਂ ਉਹਨਾਂ ਨੇ ਐਮ ਏ ਵੀ ਕੀਤੀਆਂ ਹੋਈਆਂ ਸੋ ਉਹਨਾਂ ਦੇ ਜੋ ਗੀਤ ਆ ਉਹ ਪਰਿਵਾਰ ਵਿੱਚ ਸੁਣਨ ਵਾਲੇ ਆ ਉਹਨਾਂ ਦੇ ਜਿਹੜੇ ਸਤਿੰਦਰ ਸਰਤਾਜ ਜੀ ਦੇ ਗੀਤ ਆ ਉਹਨਾਂ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਜਿਵੇਂ ਕਿ ਹਲੀਮੀ ਕਿਸੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਆ ਪੰਜਾਬ ਦੇ ਜਿਹੜੇ ਲੇਟੈਸਟ ਕੰਮ ਕਾਰ ਵਿਹਾਰ ਚੱਲ ਰਹੇ ਨੇ ਉਹਨਾਂ ਬਾਰੇ ਸਾਡੇ ਇਤਿਹਾਸ ਬਾਰੇ ਉਹਨਾਂ ਨੇ ਪੰਜਾਬ ਦੇ ਲਗਭਗ ਹਰ ਮੁੱਦੇ ਉੱਤੇ ਗੀਤ ਗਾਇਆ ਵਾ ਔਰ ਜਿਹਦੇ ਕਰਕੇ ਉਹਨਾਂ ਦੀ ਪ੍ਰਸਿੱਧੀ ਦੇਸ਼ਾਂ ਵਿਦੇਸ਼ਾਂ ਵਿੱਚ ਅੱਛੇ ਤਰੀਕੇ ਨਾਲ ਹੋ ਰਹੀ ਹੈ ਔਰ ਧਾਰਮਿਕ ਗੀਤ ਵੀ ਉਹਨਾਂ ਨੇ ਗਾਏ ਨੇ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ 'ਤੇ ਡਾਕਟਰ ਸਤਿੰਦਰ ਸਰਤਾਜ ਵਰਗਾ ਜਿਹੜਾ ਗਾਇਕ ਆ ਉਹ ਪੰਜਾਬ ਨੂੰ ਬਹੁਤ ਹੀ ਵਧੀਆ ਸੇਧ ਦੇ ਰਿਹਾ ਵਾ ਔਰ ਪੰਜਾਬ ਨੂੰ ਪੰਜਾਬ ਦੀ ਜਿਹੜੀ ਯੁਵਾ ਪੀੜ੍ਹੀ ਹੈ ਉਹਨਾਂ ਨੂੰ ਉਹਨਾਂ ਵਿੱਚ ਜਿਹੜੀਆਂ ਕੁਛ ਕੁ ਕਮੀਆਂ ਨੇ ਜਿਵੇਂ ਜ਼ਿਆਦਾ ਮੋਬਾਈਲ ਚਲਾਉਣਾ ਵੱਟਸਐਪ ਚਲਾਉਣਾ ਨਸ਼ੇ ਯੇਹ ਵੋਹ ਔਰ ਇਸ ਤੋਂ ਇਲਾਵਾ ਵੀ ਜਿਹੜੀਆਂ ਕੁਛ ਕੁਰੀਤੀਆਂ ਪੰਜਾਬ ਵਿੱਚ ਫੈਲ ਰਹੀਆਂ ਹਨ ਉਹਨਾਂ ਕੁਰੀਤੀਆਂ ਨੂੰ ਦੂਰ ਕਰਨ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੇ ਗੀਤ ਜਿਹੜੇ ਆ ਕਾਫੀ ਸਾਨੂੰ ਹੌਂਸਲਾ ਦਿੰਦੇ ਨੇ ਔਰ ਪੰਜਾਬ ਵਿੱਚ ਜਿਹੜੇ ਹਰ ਵਰਗ ਦੇ ਲੋਕ ਜਿਹੜੇ ਆ ਉਹ ਸਤਿੰਦਰ ਸਰਤਾਜ ਨੂੰ ਸੁਣਦੇ ਆ ਚਾਹੇ ਉਹ ਦਸ ਸਾਲ ਦਾ ਬੱਚਾ ਹੈ ਚਾਹੇ ਉਹ ਸੱਤਰ ਸਾਲ ਦਾ ਬਜ਼ੁਰਗ ਆ ਕੋਈ ਚਾਹੇ ਉਹ ਮਾਤਾ ਲੇਡੀਜ਼ ਹੈ ਬਜ਼ੁਰਗ ਆ ਜਾਂ ਜੈਂਟਸ ਆ ਹਰ ਵਰਗ ਦਾ ਜਿਹੜਾ ਬੰਦਾ ਆ ਉਹ ਡਾਕਟਰ ਸਤਿੰਦਰ ਸਰਤਾਜ ਜੀ ਨੂੰ ਲਾਈਕ ਕਰਦਾ ਆ ਔਰ ਇਹਨਾਂ ਦੇ ਜਿਹੜੇ ਗੀਤ ਆ ਉਸ ਵਧੀਆ ਨੇ ਔਰ ਮੈਨੂੰ ਲੱਗਦਾ ਕਿ ਸਾਡੇ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਤਿੰਦਰ ਸਰਤਾਜ ਜੀ ਦੇ ਜਿਹੜੇ ਗੀਤ ਉਹਨਾਂ ਨੂੰ ਪਸੰਦ ਕਰਨਾ ਚਾਹੀਦਾ ਧੰਨਵਾਦ